ਮੁਸਾਫੇ ਸਤਿ ਸ੍ਰੀ ਅਕਾਲ ਮੈਂ ਹਵਾਈ ਅੱਡੇ ਤੇ ਹਾਂ ਅਤੇ ਮੈਂ ਆਪਣਾ ਬਿਜਲੀ ਦਾ ਬਿਲ ਘਰ ਭੁੱਲ ਆਇਆ ਹਾਂ ਜੋ ਕੀ ਮੇਰੇ ਪਤੇ ਦੇ ਸਬੂਤ ਵਜੋਂ ਲੋੜੀਂਦਾ ਹੈ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕੀ ਮੈਂ ਡੀਜੀ ਲੋਕਰ ਤੋਂ ਇਸ ਨੂੰ ਜਲਦੀ ਕਿਵੇਂ ਪ੍ਰਾਪਤ ਕਰ ਸਕਦਾ ਹਾਂ ਗਾਹਕ ਸੇਵਾ ਪ੍ਰਤੀਨਿਧੀ ਸਤਿ ਸ੍ਰੀ ਅਕਾਲ ਕੋਈ ਗੱਲ ਨਹੀਂ ਡਿਜੀ ਲੋਕਰ ਤੋਂ ਬਿਲ ਪ੍ਰਾਪਤ ਕਰਨ ਲਈ ਪਹਿਲਾ ਆਪਣੇ ਫੋਨ ਵਿੱਚ ਡਿਜਲੋਕਰ ਐਪ ਖੋਲੋ ਜੇਕਰ ਤੁਹਾਡੇ ਕੋਲ ਐਪ ਨਹੀਂ ਹੈ ਤਾਂ ਇਸ ਨੂੰ ਡਾਊਨਲੋਡ ਕਰੋ ਅਤੇ ਆਪਣੇ ਆਧਾਰ ਕਾਰਡ ਨਾਲ ਸਾਈਨ ਅਪ ਕਰੋ ਐਪ ਖੋਲਣ ਤੋਂ ਬਾਅਦ ਜਾਰੀ ਕੀਤੇ ਦਸਤਾਵੇਜ਼ ਭਾਗ ਤੇ ਜਾਓ ਜਾਂ ਸਰਚ ਬਾਰ ਵਿੱਚ ਬਿਜਲੀ ਬਿਲ ਟਾਈਪ ਕਰੋ ਆਪਣੀ ਬਿਜਲੀ ਬੋਰਡ ਦੀ ਚੋਣ ਕਰੋ ਅਤੇ ਆਪਣਾ ਖਾਤਾ ਨੰਬਰ ਜਾਂ ਹੋਰ ਲੋੜੀਂਦੀ ਜਾਣਕਾਰੀ ਦਰਜ ਕਰੋ ਤੁਹਾਡਾ ਬਿੱਲ ਡਿਜੀਲੋਕਰ ਵਿੱਚ ਆ ਜਾਵੇਗਾ ਜਿਸ ਨੂੰ ਤੁਸੀਂ ਡਾਊਨਲੋਡ ਕਰਕੇ ਦਿਖਾ ਸਕਦੇ ਹੋ ਗਾਹਕ ਸੇਵਾ ਪ੍ਰਤੀ ਨਿਧੀ ਕੋਈ ਗੱਲ ਨਹੀਂ ਤੁਸੀਂ ਆਪਣੇ ਨਜ਼ਦੀਕੀ ਸਾਈਬਰ ਕੈਫੇ ਜਾਂ ਕਿਸੇ ਹੋਰ ਦੋਸਤ ਜਾਂ ਪਰਿਵਾਰਿਕ ਮੈਂਬਰ ਤੋਂ ਮਦਦ ਲੈ ਸਕਦੇ ਹੋ ਜਿਨਾਂ ਕੋਲ ਇੰਟਰਨੈਟ ਦੀ ਸਹੂਲਤ ਹੋਵੇ ਤੁਸੀਂ ਆਪਣੇ ਮੋਬਾਇਲ ਡਾਟਾ ਦੀ ਵਰਤੋਂ ਕਰਕੇ ਵੀ ਦਸਤਾਵੇਜ ਭੇਜ ਸਕਦੇ ਹੋ ਜੇਕਰ ਇਹ ਵੀ ਸੰਭਵ ਨਹੀਂ ਹੈ ਤਾਂ ਤੁਸੀਂ ਦਸਤਾਵੇਜ਼ ਨੂੰ ਪ੍ਰਿੰਟ ਕਰਵਾ ਕੇ ਕਿਸੇ ਹੋਰ ਨੂੰ ਦੇ ਸਕਦੇ ਹੋ